ਚਿੱਤਰਕਾਰੀ ਕਰਨ ਦੇ ਸਮੇਂ ਮੈਨੂੰ ਕਈ ਤਰ੍ਹਾਂ ਦੇ ਕਲਰਸ ਦੀ ਕ ਬਰੈਂਡ ਪਸੰਦ ਹੈ ਜਿਵੇਂ ਕਿ ਡੋਮਸ ਅਤੇ ਨਟਰਾਜ ਡੋਮਸ ਅਤੇ ਨਟਰਾਜ ਦੇ ਜੋ ਸ਼ੇਡਜ ਹੁੰਦੇ ਆ ਪੈਨਸਲ ਦੇ ਉਹ ਕਾਫ਼ੀ ਵਧੀਆ ਹੁੰਦੇ ਆ ਅਤੇ ਜ਼ਿਆਦਾਤਰ ਮੈਂ ਡੋਮਸ ਦੇ ਕਲਰ ਯੂਜ਼ ਕਰਦੀ ਹਾਂ ਬਿਕੋਜ਼ ਡੋਮਸ ਦੇ ਕਲਰ ਦਾ ਬਰੈਂਡ ਬਹੁਤ ਅੱਛਾ ਹੁੰਦਾ ਹੈ ਅਤੇ ਕੋਆਲੀਟੀ ਵੀ ਬਹੁਤ ਅੱਛੀ ਹੁੰਦੀ ਹੈ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਲਾਈਟ ਔਰ ਡਾਰਕ ਸ਼ੇਡਜ਼ ਹੁੰਦੇ ਹਨ ਜੋ ਕਿ ਬਹੁਤ ਹੀ ਅਲੱਗ ਅਲੱਗ ਯੂਨੀਕ ਟਾਈਪਸ ਦੇ ਹੁੰਦੇ ਹਨ ਮੈਨੂੰ ਜ਼ਿਆਦਾਤਰ ਪੈਨਸਿਲ ਵਾਲੀ ਡਰਾਇੰਗ ਕਰ ਸਕੈਚਿੰਗ ਅੱਛੀ ਲੱਗਦੀ ਹੈ ਜਿਹਦੇ ਕਰਕੇ ਮੈਂ ਪੈਨਸਿਲ ਕਲਰਜ਼ ਯੂਜ਼ ਕਰਦੀ ਹਾਂ ਅਤੇ ਡੋਮਸ ਕੰਪਨੀ ਸਭ ਤੋਂ ਬੈਸਟ ਹੈ ਮੈਂ ਇਹ ਕਲਰਜ਼ ਆਪਣੇ ਸਕੂਲ ਦੇ ਕੋਲ ਦੀ ਦੁਕਾਨ ਤੋਂ ਲੈਂਦੀ ਹਾਂ ਜਿਸਦਾ ਨਾਮ ਗੁਰ ਗੁਰੂ ਕਿਰਪਾ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੀ ਸ਼ੌਪਸ਼ ਹਨ ਜਿੱਥੇ ਬਹੁਤ ਹੀ ਵਧੀਆ ਵਧੀਆ ਸਪਲਾਈ ਹੁੰਦੀ ਹੈ ਪਰ ਮੈਨੂੰ ਉੱਥੇ ਤੋਂ ਹੀ ਪਸੰਦ ਹਨ ਜਿੱਥੇ ਸਾਡੇ ਸਕੂਲ ਦੇ ਲਾਗੇ ਹੈ ਅਤੇ ਇਹ ਕਲਰਜ਼ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਇਨ੍ਹਾਂ ਦੀ ਸਟੇਸ਼ਨਰੀ ਵੀ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਕਿਉਂਕਿ ਇਹ ਖਰੀਦਣੇ ਵੀ ਸਸਤੇ ਹੁੰਦੇ ਹਨ ਅਤੇ ਡੋਮਸ ਮੈਨੂੰ ਬਹੁਤ ਹੀ ਵਧੀਆ ਲੱਗਦੇ ਹਨ ਇਹ ਕਲਰ ਸਭ ਤੋਂ ਬੈਸਟ ਕਲਰ ਹੁੰਦੇ ਹਨ ਅਤੇ ਇਨ੍ਹਾਂ ਦੀ ਕੋਆਲਟੀ ਵੀ ਬਹੁਤ ਅੱਛੀ ਹੁੰਦੀ ਹੈ